ਰਾਜ ਸਰਕਾਰ ਪੰਜਾਬ ਵਿੱਚ ਭ੍ਰਿਸ਼ਟਾਚਾਰ ਅਤੇ ਪਾਰਦਰਸ਼ਤਾ ਨਾਲ ਸੰਬੰਧਿਤ ਮੁੱਦਿਆਂ ਨੂੰ ਕੁਛ ਇਸ ਤਰ੍ਹਾਂ ਹੱਲ ਕਰਦੀ ਹੈ ਕਿ ਜਿਵੇਂ ਅੱਜ ਕੱਲ੍ਹ ਟ੍ਰੇਡਿੰਗ ਦਾ ਜਮਾਨਾ ਹੈ ਸੋ ਕਈ ਸਾਲ ਪਹਿਲਾਂ ਟ੍ਰੇਡਿੰਗ ਹੋਂਦ ਵਿੱਚ ਆਈ ਸੀ ਜਿਹੜੀ ਕੀ ਲੋਕ ਅੱਜ ਵੀ ਕਰ ਰਹੇ ਹਨ ਅਤੇ ਸਾਨੂੰ ਨਹੀਂ ਅਸੀਂ ਨਹੀਂ ਕਹਿ ਸਕਦੇ ਹੁਣ ਕੀ ਇਹ ਟ੍ਰੇਡਿੰਗ ਸਹੀ ਹੈ ਜਾਂ ਗਲਤ ਹੈ ਕਿਉਂਕਿ ਇਹ ਵੱਡੇ ਵੱਡੇ ਬੰਦਿਆਂ ਦਾ ਕੰਮ ਹੈ ਜਿਹੜੀ ਕਿ ਟ੍ਰੇਡਿੰਗ ਬਹੁਤ ਤਕੜੇ ਤਕੜੇ ਲੋਕ ਚਲਾਉਂਦੇ ਹਨ ਇਸ ਬਾਰੇ ਸਾਨੂੰ ਇੰਨਾ ਗਿਆਨ ਨਹੀਂ ਹੈ ਇਨਫਲੇਂਸਰ ਦੀ ਗੱਲ ਕਰੀਏ ਤਾਂ ਲੋਕ ਅੱਜ ਕੱਲ੍ਹ ਇੰਸਟਾਗ੍ਰਾਮ ਵਿੱਚ ਇਨਫਲੇਂਸਿੰਗ ਕਰਦੇ ਹਨ ਜਿਵੇਂ ਕੋਈ ਵੀ ਵੀਡੀਓ ਬਣਾ ਲਈ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਦੇ ਦੇ ਦਿੱਤੀ ਗਈ ਪੰਜਾਬ ਸਰਕਾਰ ਇਹਨਾਂ ਨੂੰ ਬੜਾਵਾ ਦੇ ਰਹੀ ਹੈ ਪੋਲੀਟੀਕਲ ਇੰਸਟੇਬਿਲਟੀ ਜਿਵੇਂ ਹੋਗੀ ਸੋ ਇਹ ਸਾਰੀਆਂ ਚੀਜ਼ਾਂ ਵਿੱਚ ਸਰਕਾਰ ਬਹੁਤ ਹੀ ਵਧੀਆ ਤਰੀਕੇ ਨਾਲ ਕੰਮ ਕਰ ਰਹੀ ਹੈ ਅਤੇ ਮੈਨੂੰ ਆਸ ਹੈ ਕਿ ਸਰਕਾਰ ਇੱਦਾਂ ਹੀ ਕੰਮ ਕਰਦੀ ਰਹੇਗੀ ਇਸ ਚੀਜ਼ ਨੂੰ ਬੰਦ ਨਹੀਂ ਕਰੇਗੀ